ਜੀ ਜ ਮੈਂ ਇੱਕ ਫੋਟੋਗ੍ਰਾਫਰ ਹਾਂ ਅਤੇ ਮੈਂ ਸੋਚਦਾ ਕਿ ਆਪਦੀ ਫੋਟੋਗ੍ਰਾਫੀ ਨੂੰ ਮੈਂ ਸੁਧਾਰਾਂਗਾ ਆਪਦੀ ਫੋਟੋਗਰਾਫਸ ਨੂੰ ਸੁਧਾਰਾਂਗਾ ਤਾਂ ਮੈਂ ਉਹਦੇ ਲਈ ਕਈ ਸਾਰੇ ਚੇਂਜਿਸ ਕਰ ਸਕਦਾ ਹਾਂ ਮੰਨ ਲਓ ਕਿ ਮੇਰੇ ਕੋਲ ਕੋਈ ਇਨਸਾਨ ਆਉਂਦਾ ਕੋਈ ਕਸਟਮਰ ਆਉਂਦਾ ਉਹ ਫੋਟੋ ਖਿਚਾਉਣ ਲਈ ਆਉਂਦਾ ਹੈ ਸਭ ਤੋਂ ਪਹਿਲੇ ਤਾਂ ਮੈਂ ਆਪਦੇ ਕੈਮਰੇ ਦੇ ਮੋਡ ਨੂੰ ਸੈਟ ਕਰਾਂਗਾ ਦਿਨ ਦੇ ਹਿਸਾਬ ਨਾਲ ਦੁਪਹਿਰ ਹੈ ਦਿਨ ਹੈ ਰਾਤ ਹੈ ਸ਼ਾਮ ਹੈ ਉਸ ਹਿਸਾਬ ਨਾਲ ਆਪਦੇ ਫੋਨ ਦੇ ਮੋਡ ਨੂੰ ਆਪਦੇ ਕੈਮਰਾ ਦੇ ਮੋਡ ਨੂੰ ਸੈਟ ਕਰਾਂਗਾ ਅਤੇ ਉਸ ਤੋਂ ਬਾਅਦ ਚੈਕ ਕਰਾਂਗੇ ਲਾਈਟਿੰਗ ਕੀ ਆ ਜੇ ਜ਼ਰੂਰਤ ਪੜੇਗੀ ਪਏਗੀ ਤਾਂ ਮੈਂ ਅੰਦਰ ਲਾਈਟ ਵੀ ਜਲਾਵਾਂਗਾ ਜਿਹੜੀ ਫੋਟੋਗ੍ਰਾਫੀ ਦੀ ਹੈਵੀ ਲਾਈਟ ਆਉਂਦੀ ਹੈ ਉਹ ਜਲਾਵਾਂਗਾ ਅਤੇ ਦੇਖਾਂਗਾ ਕਿ ਸੂਰਜ ਕਿਤੇ ਇਫੈਕਟ ਤਾਂ ਨਹੀਂ ਕਰ ਰਿਹਾ ਮੇਰਾ ਜਿਹੜਾ ਰੂਮ ਹੈ ਉਹਦੇ 'ਚ ਸੂਰਜ ਤਾਂ ਇਫੈਕਟ ਨਹੀਂ ਕਰ ਰਿਹਾ ਕੈਮਰਾ ਸੂਰਜ ਵਾਲੇ ਪਾਸੇ ਨਹੀਂ ਹੋਣਾ ਚਾਹੀਦਾ ਅਤੇ ਗਰੂਮਿੰਗ ਦੀ ਜੇ ਕਸਟਮਰ ਨੂੰ ਲੋੜ ਹੈਗੀ ਹੈ ਕੌਂਬ ਕਰਨ ਦੀ ਜਾਂ ਫਿਰ ਕਿਸੇ ਤਰ੍ਹਾਂ ਦੀ ਲੇਡੀ ਕਸਟਮਰ ਨੂੰ ਕੋਈ ਹੋਰ ਗਰੂਮਿੰਗ ਦੀ ਲੋੜ ਹੈ ਉਹ ਉਹਦੇ 'ਚ ਵੀ ਮੈਂ ਬਦਲਾਵ ਲਿਆਵਾਂਗਾ ਜੇ ਲੋੜ ਪਈ ਤਾਂ ਰਾਤ ਦਿਨ ਦੇਖਾਂਗਾ ਲਾਈਟਿੰਗ ਨੂੰ ਸਹੀ ਕਰਾਂਗਾ ਅਤੇ ਹੋਰ ਕੀ ਕਹਿੰਦੇ ਹੈ ਆਪਦੇ ਮੋਡ ਨੂੰ ਸਹੀ ਰੱਖਾਂਗਾ ਤਾਂ ਬਹੁਤ ਬਹੁਤ ਧੰਨਵਾਦ ਜੀ